ਪੰਜਾਬੀ ਭਾਸ਼ਾ ਸਭ ਤੋਂ ਵੱਧ ਬੋਲੀ ਜਾਣ ਵਾਲੀ ਇੰਡੋ ਆਰੀਅਨ ਭਾਸ਼ਾਵਾਂ ਵਿੱਚੋਂ ਇੱਕ ਹੈ ਪੁਰਾਣੀ ਬ੍ਰਿਟਿਸ਼ ਸਪੈਲਿੰਗ ਪੰਜਾਬੀ ਅਕਾਦਮਿਕ ਤੌਰ 'ਤੇ ਸਹੀ ਪੰਜਾਬੀ ਨਾਲ਼ੋਂ ਵਧੇਰੇ ਆਮ ਵਰਤੋਂ ਵਿੱਚ ਰਹਿੰਦੀ ਹੈ ਇੱਕੀਵੀਂ ਸਦੀ ਦੇ ਸ਼ੁਰੂ ਵਿੱਚ ਭਾਰਤ ਵਿੱਚ ਬੋਲੀ ਜਾਣ ਵਾਲਿਆਂ ਦੀ ਗਿਣਤੀ ਤੀਹ ਕਰੋੜ ਸੀ ਇਹ ਭਾਰਤ ਦੇ ਪੰਜਾਬ ਰਾਜ ਦੀ ਸਰਕਾਰੀ ਭਾਸ਼ਾ ਹੈ ਅਤੇ ਭਾਰਤੀ ਸੰਵਿਧਾਨ ਦੁਆਰਾ ਮਾਨਤਾ ਪ੍ਰਾਪਤ ਭਾਸ਼ਾਵਾਂ ਵਿੱਚੋਂ ਇੱਕ ਹੈ ਭਾਰਤ ਵਿੱਚ ਪੰਜਾਬੀ ਨੂੰ ਵਿਲੱਖਣ ਰੂਪ ਵਿੱਚ ਲਿਖਿਆ ਜਾਂਦਾ ਹੈ ਗੁਰਮੁਖੀ ਲਿਪੀ ਜੋ ਕਿ ਖਾਸ ਤੌਰ 'ਤੇ ਸਿੱਖਾਂ ਨਾਲ ਜੁੜੀ ਹੋਈ ਹੈ ਇਹ ਲਿਪੀ ਖੱਬੇ ਤੋਂ ਸੱਜੇ ਲਿਖੀਆਂ ਗਈਆਂ ਹਨ ਲਿਪੀਆਂ ਦੇ ਇੰਡਿਕ ਪਰਿਵਾਰਕ ਦਾ ਇੱਕ ਮੈਂਬਰ ਹੈ ਪਰ ਇਸ ਦੇ ਸੰਗਠਨ ਵਿੱਚ ਇਹ ਹਿੰਦੀ ਲਿਖਣ ਲਈ ਵੀ ਵਰਤੀ ਜਾਂਦੀ ਹੈ ਦੇਵਨਾਗਰੀ ਤੋਂ ਕਾਫ਼ੀ ਪ੍ਰ ਵੱਖਰੀ ਹੈ ਉਰਦੂ ਲਿਪੀ ਸੱਜੇ ਤੋਂ ਖੱਬੇ ਪਾਕਿਸਤਾਨ ਵਿੱਚ ਪੰਜਾਬੀ ਲਿਖਣ ਲਈ ਵਰਤੀ ਜਾਂਦੀ ਹੈ ਜਿੱਥੇ ਅੱਜ ਕੱਲ੍ਹ ਇਸ ਨੂੰ ਸ਼ਾਹਮੁਖੀ ਨਾਮ ਦਿੱਤਾ ਜਾਂਦਾ ਹੈ ਇਸ ਤਰ੍ਹਾਂ ਪੰਜਾਬੀ ਅੱਜ ਦੁਨੀਆਂ ਦੀਆਂ ਉਹਨਾਂ ਬਹੁਤ ਘੱਟ ਭਾਸ਼ਾਵਾਂ ਵਿੱਚੋਂ ਇੱਕ ਹੈ ਜੋ ਦੋ ਬਿਲਕੁਲ ਵੱਖਰੀਆਂ ਅਤੇ ਆਪਸੀ ਸਮਝ ਤੋਂ ਬਾਹਰ ਲਿਪੀਆਂ ਵਿੱਚ ਲਿਖੀਆਂ ਜਾਂਦੀਆਂ ਹਨ